ਨਿਊਜ਼ ਮੀਡੀਆ ਉਨ੍ਹਾਂ ਵਿਦਿਆਰਥੀਆਂ ਦੀ ਬਹੁਤ ਮਦਦ ਕਰਦਾ ਹੈ ਜਿਹੜੇ ਕਿ ਯੂ ਪੀ ਐਸ ਸੀ ਆਦਿ ਪ੍ਰੀਖਿਆ ਦੀ ਤਿਆਰੀ ਕਰਦੇ ਹਨ ਜੇ ਅਸੀਂ ਅਖਬਾਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਅਖਬਾਰਾਂ ਹਨ ਜਿਵੇਂ ਕਿ ਅਜੀਤ ਅਖਬਾਰ ਜੱਗ ਬਾਣੀ ਅਖਬਾਰ ਦੈਨਿਕ ਭਾਸਕਰ ਸਪੋਕਮੈਨ ਹਿੰਦੁਸਤਾਨ ਟਾਈਮਸ ਟ੍ਰਿਬਿਊਨ ਆਦਿ ਜਿਨ੍ਹਾਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਛਪਦੀਆਂ ਹਨ ਹਰ ਤਰ੍ਹਾਂ ਦੀਆਂ ਖਬਰਾਂ ਜਿਵੇਂ ਕਿ ਰਾਜਨੀਤਿਕ ਨਾਲ ਸੰਬੰਧਿਤ ਸਿਹਤ ਨਾਲ ਨਾਲ ਸੰਬੰਧਿਤ ਆਵਾਜਾਈ ਨਾਲ ਸੰਬੰਧਿਤ ਅਤੇ ਫਿਲਮ ਜਗਤ ਦੀਆਂ ਖਬਰਾਂ ਆਉਂਦੀਆਂ ਹਨ ਜਦੋਂ ਯੂ ਪੀ ਐਸ ਸੀ ਦੀ ਤਿਆਰੀ ਕਰਨ ਵਾਲੇ ਬੱਚੇ ਅਖਬਾਰ ਪੜ੍ਹਦੇ ਹਨ ਅਤੇ ਉਹਨਾਂ ਨੂੰ ਸਾਰੇ ਹੀ ਵਿਸ਼ਿਆਂ ਦਾ ਗਿਆਨ ਹੋ ਜਾਂਦਾ ਹੈ ਕਿ ਸਾਡੇ ਆਲੇ ਦੁਆਲੇ ਸੰਸਾਰ ਵਿੱਚ ਕੀ ਵਾਪਰ ਰਿਹਾ ਹੈ ਅਤੇ ਨਿਊਜ ਚੈਨਲ ਵੀ ਜਦੋਂ ਦੇਖਦੇ ਹਨ ਤਾਂ ਉੱਥੇ ਵੀ ਬਹੁਤ ਸਾਰਾ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਉਹਨਾਂ ਨਾਲ ਯਾਦਾਸ਼ਤ ਬਹੁਤ ਤੇਜ਼ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਉਹ ਯੂ ਪੀ ਐਸ ਦੀ ਪ੍ਰੀਖਿਆ ਦੀ ਤਿਆਰੀ ਬਹੁਤ ਹੀ ਆਸਾਨੀ ਨਾਲ ਕਰ ਲੈਂਦੇ ਹਨ ਅਤੇ ਚੰਗੇ ਅਫਸਰ ਬਣ ਜਾਂਦੇ ਹਨ